ਪੰਜਾਬ ਵਿਚ ਖਾਸ ਤੌਰ 'ਤੇ ਰੂਪਨਗਰ ਜ਼ਿਲ੍ਹੇ ਵਿੱਚ ਅਜੂਬਾ ਜਿਹੜਾ ਅਨੰਦਪੁਰ ਸਾਹਿਬ ਵਿੱਚ ਹੈ ਉਹ ਬਹੁਤ ਮਹੱਤਵਪੂਰਨ ਹੈ ਆਕਰਸ਼ਣ ਹੈ ਧਾਰਮਿਕ ਹੈ ਅਤੇ ਸਿੱਖਿਆ ਦਾਇਕ ਹੈ ਇਸ ਲਈ ਮੈਂ ਚਾਹਵਾਂਗਾ ਕਿ ਇਹਦੇ ਜ਼ਰੀਏ ਇੱਥੇ ਸੈਰ ਸਪਾਟਾ ਜਿਹੜਾ ਹੈ ਵਧਾਇਆ ਜਾ ਸਕਦਾ ਹੈ ਅਤੇ ਉਹਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ